ਹੈਲੋ ਹਾਂਜੀ ਕੌਣ

ਹਾਂਜੀ ਹਾਂਜੀ ਤੁਸੀਂ ਕਿਵੇਂ ਕੌਣ ਜੀ ਅੱਛਾ ਜੀ ਕਿਵੇਂ ਕੱਲ ਕੱਲ ਡਾਕਟਰ ਛੁੱਟੀ 'ਤੇ ਸੀ ਜੀ ਹਾਂਜੀ ਕਿਵੇਂ

ਅੱਛਾ ਅਤੇ ਓ ਹਾਂਜੀ ਕੱਲ ਤਾਂ ਮੈਮ ਡਾਕਟਰ ਛੁੱਟੀ 'ਤੇ ਸੀ ਵੀ ਜਾਂ ਤਾਂ ਤੁਸੀਂ ਕੱਲ ਨੂੰ ਆ ਜਿਓ ਅਤੇ ਫਿਰ ਨਹੀਂ ਤਾਂ ਫਿਰ ਸੈਚਡੇ ਸੰਡੇ ਦੀ ਅੱਗੇ ਹੋ ਸਕਦਾ ਛੁੱਟੀ ਆ ਜੂ ਗੀ ਅੱਗੇ ਫੇਰ ਨਹੀਂ ਫੇਰ ਤੁਹਾਨੂੰ ਮੰਡੇ ਨੂੰ ਆਉਣਾ ਪਊਗਾ ਕੀ ਪ੍ਰੋਬਲਮ ਕੀ ਹੈ ਮੈਮ ਤੁਹਾਡੀ ਅੱਛਾ ਅੱਛਾ ਪਹਿਲਾਂ ਕੋਈ ਦਵਾਈ ਦਵੁਈ ਲੇਤੀ ਹੈ ਤੁਸੀਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਟੈਸਟ ਵਗੈਰਾ ਕਰਵਾਏ ਵੇ ਮੈਮ ਪਹਿਲਾਂ ਤੁਸੀਂ ਕੋਈ ਅੱਛਾ ਓ ਹਾਂ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਕੱਲ ਨੂੰ ਆਉਣਗੇ ਮੈਮ ਜਾਂ ਤਾਂ ਕੱਲ ਨੂੰ ਆਜਿਓ ਜੇ ਬਾਏ ਚਾਂਸ ਕੱਲ ਨੂੰ ਕੋਈ ਬਾਰਿਸ਼ ਵਗੈਰਾ ਕਰਕੇ ਨਾ ਆਇਆ ਗਿਆ ਤਾਂ ਫਿਰ ਮੈਮ ਤੁਸੀਂ ਮੰਡੇ ਨੂੰ ਆਜਿਓ ਕਿਉਂਕਿ ਹੋ ਸਕਦਾ ਸੈਚਡੇ ਸੰਡੇ ਛੁੱਟੀ ਹੋਵੇ ਫਿਰ ਤੁਸੀਂ ਮੰਡੇ ਨੂੰ ਆ ਕੇ ਨਾਲੇ ਟੈਸਟ ਵਗੈਰਾ ਕਰਾ ਜਿਓ ਟਾਇਮ ਨਾਲ ਅਤੇ ਨਾਲੇ ਫਿਰ ਆ ਕੇ ਆਪਦੀ ਮੈਡੀਸਨ ਵਗੈਰਾ ਲੈ ਜਿਓ ਹਾਂਜੀ ਡੋਕਟਰ ਸਵੇਰੇ ਆ ਜਾਂਦੇ ਹੈ ਜੀ ਨੌ ਕੁ ਵਜੇ ਨੌ ਕੁ ਵਜੇ ਬੈਠ ਜਾਂਦੇ ਨੇ ਫਿਰ ਉਹ ਉਸ ਤੋਂ ਬਾਅਦ ਲੰਚ ਟਾਇਮ ਹੋ ਜਾਂਦਾ ਹੈ ਦੋ ਕੁ ਵਜੇ ਵੀ ਇਸ ਹਿਸਾਬ ਨਾਲ ਆਇਓ ਤਾਂ ਕਿ ਵੀ ਤੁਹਾਨੂੰ ਪ੍ਰੋਬਲਮ ਨਾ ਆਵੇ ਹੈ ਨਾ ਵੀ ਤੁਸੀਂ ਬਾਹਰੋਂ ਆ ਰਹੇ ਹੋ ਵੀ ਕਈ ਵਾਰੀ ਹੁੰਦਾ ਵੀ ਲੇਟ ਜ਼ਿਆਦਾ ਲੇਟ ਵੀ ਨਾ ਹੋ ਜਿਓ ਸਾਢੇ ਅੱਠ ਨੌ ਵਜੇ ਪਹੁੰਚ ਜਿਓ ਪਰਚੀ ਵਗੈਰਾ ਕਟਵਾਉਣ 'ਤੇ ਟਾਇਮ ਲੱਗ ਜਾਂਦਾ ਫੀਸ ਸੌ ਰੁਪਏ ਹੀ ਹੈ ਮੈਮ ਹਾਂ ਫੀਸ ਸੌ ਰੁਪਏ ਹੈ ਮਤਲਬ ਤੁਹਾਡੀ ਪਰਚੀ ਕਟਵਾਉਣ ਦੀ ਉਸ ਤੋਂ ਬਾਅਦ ਜੋ ਵੀ ਹੋਊਗਾ ਤੁਹਾਡੀ ਕੋਈ ਜਿੱਦਾਂ ਦੀ ਮੈਡੀਸਨ ਲੱਗੇਗੀ ਜਾਂ ਕੋਈ ਟੈਸਟ ਹੋਊਗਾ ਉਹ ਅਲੱਗ ਤੋਂ ਹੈ ਉਹਦਾ ਫਿਰ ਤੁਹਾਨੂੰ ਦੱਸਿਆ ਜਾਊ ਟਾਇਮ 'ਤੇ ਟੈਸਟ ਕਿਵੇਂ ਹੁੰਦੇ ਆ ਵਈ ਜਾਂ ਕੋਈ ਐਕਸਟਰਾ ਹੋਣਾ ਜਾਂ ਪੇਟ 'ਚ ਕੋਈ ਪ੍ਰੋਬਲਮ ਹੈ ਤਾਂ ਅਲਟਰਾਸਾਉਂਡ ਵਗੈਰਾ ਹੋਊਗਾ ਉਹ ਤੁਹਾਨੂੰ ਦੱਸਣਗੇ ਜਿਵੇਂ ਵੀ ਡੋਕਟਰ ਉਵੇਂ ਕਰ ਲਿਓ ਹਾਂ ਕੋਸ਼ਿਸ਼ ਕਰਿਓ ਵੀ ਖਾਲੀ ਪੇਟ ਆਵੋ ਕਈ ਵਾਰੀ ਕੋਈ ਇਹੋ ਜਿਹਾ ਟੈਸਟ ਕਰਵਾਉਣਾ ਪੈਂਦਾ ਵੀ ਖਾਲੀ ਪੇਟ ਕਰਵਾਉਣਾ ਤਾਂ ਕਰਕੇ ਤੁਸੀਂ ਥੋੜ੍ਹਾ ਜਲਦੀ ਆ ਜਿਓ ਖਾਲੀ ਪੇਟ ਆ ਜਿਓ ਅਤੇ ਫਿਰ ਤੁਹਾਡੇ ਉੱਦਾਂ ਦੇ ਟੈਸਟ ਹੋ ਜਾਣਗੇ ਫਿਰ ਕੋਈ ਜ਼ਿਆਦਾ ਟਾਇਮ ਨਹੀਂ ਲੱਗੇਗਾ ਨਾਲੇ ਤੁਹਾਨੂੰ ਨਹੀਂ ਫਿਰ ਦੁਬਾਰੇ ਦੁਬਾਰੇ ਚੱਕਰ ਮਾਰਨਾ ਪੈਂਦਾ ਫਿਰ ਉਹ 'ਚ ਤੁਹਾਨੂੰ ਪ੍ਰੋਬਲਮ ਹਾਂ ਠੀਕ ਹੈ ਠੀਕ ਹੈ ਓਕੇ ਬਾਏ